ਇੱਕ ਜਨਵਰੀ ਦੋ ਹਜ਼ਾਰ ਤੇਈ ਪੰਜ ਫਰਵਰੀ ਦੋ ਹਜ਼ਾਰ ਤੇਈ ਚਾਰ ਮਾਰਚ ਦੋ ਹਜ਼ਾਰ ਤੇਈ ਛੱਬੀ ਅਪ੍ਰੈਲ ਦੋ ਹਜ਼ਾਰ ਤੇਈ ਦਸ ਅਗਸਤ ਦੋ ਹਜ਼ਾਰ ਤੇਈ